ਅੱਜ ਤੋਂ ਮਹੀਨਾ ਕੁ ਪਹਿਲਾਂ ਮੈਂ ਐਮਾਜੋਨ ਤੋਂ ਹੈਡਫੋਸ ਮੰਗਵਾਏ ਸੀਗੇ ਯੂਬੋਨ ਕੰਪਨੀ ਦੇ ਤਾਂ ਮੈਨੂੰ ਉਹਨਾਂ ਦਾ ਪ੍ਰੋਡਕਟ ਅਤੇ ਉਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਉਹਨਾਂ ਨੇ ਮੈਨੂੰ ਪੰਦਰਾਂ ਦਿਨ ਦਾ ਟਾਈਮ ਦਿੱਤਾ ਸੀ ਤਾਂ ਉਹਨਾਂ ਨੇ ਪੰਦਰਾਂ ਦਿਨਾਂ ਦੇ ਅੰਦਰ ਹੀ ਪ੍ਰੋਡਕਟ ਮੈਨੂੰ ਲਿਆ ਕੇ ਦਿੱਤਾ ਅਤੇ ਉਹਨਾਂ ਦੀ ਸਰਵਿਸ ਚੰਗੀ ਸੀ ਅਤੇ ਮੈਨੂੰ ਪ੍ਰੋਡਕਟ ਵੀ ਬਹੁਤ ਚੰਗਾ ਲੱਗਿਆ ਉਹਨਾਂ ਨੇ ਸਰਵਿਸ ਪ੍ਰੋਡਕਟ ਮੈਨੂੰ ਵਧੀਆ ਡਿਲਿਵਰ ਕੀਤਾ ਕੋਈ ਉਹਦੇ 'ਚ ਖਰਾਬੀ ਨਹੀਂ ਸੀ ਕੋਈ ਡਿਫਾਲਟ ਪਾਰਟ ਨਹੀਂ ਸੀਗਾ ਤਾਂ ਮੈਨੂੰ ਪ੍ਰੋਡਕਟ ਲੈ ਕੇ ਬਹੁਤ ਖੁਸ਼ੀ ਹੋਈ ਪ੍ਰੋਡਕਟ ਬਹੁਤ ਵਧੀਆ ਸੀ ਉਹਦੀ ਬੈਂਟਰੀ ਕੁਆਲਿਟੀ ਬਹੁਤ ਵਧੀਆ ਚੱਲ ਚੱਲਦੀ ਹੈ ਸਾਊਂਡ ਕੁਆਲਿਟੀ ਵੀ ਬਹੁਤ ਅੱਛੀ ਹੈ ਯੂਬੋਨ ਕੰਪਨੀ ਇਕ ਮੈਨੂੰ ਵਧੀਆ ਕੰਪਨੀ ਲੱਗੀ ਅਤੇ ਮੈਨੂੰ ਪ੍ਰੋਡਕਟ ਸੀ ਜੋ ਉਹ ਮਿਲਿਆ ਵੀ ਸੀ ਔਫ਼ਰ ਦੇ ਵਿਚ ਸੀਗਾ ਤਾਂ ਮੈਨੂੰ ਬਹੁਤ ਸਸਤੇ ਰੇਟ 'ਤੇ ਮਿਲ ਗਿਆ ਸੀ ਤਾਂ ਇਸ ਲਈ ਮੈਂ ਇਹ ਮੌਕਾ ਗੁਆਉਣਾ ਨਹੀਂ ਚਾਹੁੰਦਾ ਸੀ ਅਤੇ ਮੈਂ ਉਸਨੂੰ ਔਡਰ ਕਰ ਦਿੱਤਾ ਔਡਰ ਕਰ ਦਿੱਤਾ ਅਤੇ ਮੇਰੇ ਕੋਲ ਪ੍ਰੋਡਕਟ ਅੱਜ ਬਹੁਤ ਵਧੀਆ ਕੰਡੀਸ਼ਨ 'ਚ ਚੱਲ ਰਿਹਾ ਹੈ ਤਾਂ ਮੈਂ ਪ੍ਰੋਡਕਟ ਨੂੰ ਲੈ ਕੇ ਬਹੁਤ ਖੁਸ਼ ਹਾਂ ਮੇਰਾ ਐਕਸਪੀਰੀਅੰਸ ਇਸ ਪ੍ਰੋਡਕਟ ਨਾਲ ਬਹੁਤ ਵਧੀਆ ਰਿਹਾ ਅੱਜ ਕੱਲ੍ਹ ਵੀ ਮੈਂ ਹਮੇਸ਼ਾ ਉਸ 'ਤੇ ਸੌਂਗਸ ਵੀਡਿਓਸ ਸੁਣਦਾ ਹਾਂ ਮੈਂ ਮੂਵੀਸ ਦੇਖਦਾ ਹਾਂ ਮੈਂ ਗੇਮ ਵੀ ਗੇਮਿੰਗ ਵੀ ਉਸ ਹੈਡਫੋਨਸ ਨਾਲ ਕਰਦਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਹਿੰਦਾ ਹੈ ਮੈਨੂੰ ਬਹੁਤ ਚੰਗਾ ਲੱਗਿਆ ਇਹ ਪ੍ਰੋਡਕਟ ਖਰੀਦ ਕੇ